ਪੱਚੀ ਅਗਸਤ ਉੱਨੀ ਸੌ ਇਕਾਨਵੇਂ ਤਿੰਨ ਜੁਲਾਈ ਉੱਨੀ ਸੌ ਬਾਨਵੇਂ ਉੱਨੀ ਫਰਵਰੀ ਉੱਨੀ ਸੌ ਨੜਿਨਵੇਂ ਪੰਦਰਾਂ ਅਗਸਤ ਉੱਨੀ ਸੌ ਛਿਆਨਵੇਂ ਸਤਾਈ ਨਵੰਬਰ ਦੋ ਹਜ਼ਾਰ ਉੱਨੀ